ਇੱਕ ਬਾਈਕਰ ਨੂੰ ਸਾਰਿਆਂ ਤੋਂ ਪਹਿਲਾਂ ਰੂਲ ਤਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਲਾਈਸੈਂਸ ਦੇ ਬਿਨ੍ਹਾਂ ਉਹਨੂੰ ਨਹੀਂ ਚਲਾਉਣਾ ਚਾਹੀਦਾ ਅਠਾਰਾਂ ਸਾਲ ਤੋਂ ਥੱਲੇ ਵਾਲਾ ਬਾਈਕਰ ਨਹੀਂ ਬਣ ਸਕਦਾ ਕਿਉਂਕਿ ਬਿਨਾਂ ਸ ਲਾਈਸੈਂਸ ਤੋਂ ਜੇ ਆਪਾਂ ਚਲਾਵਾਂਗੇ ਇਹ ਹੀ ਕਾਰਨ ਹੈ ਕਿ ਸਾਡਾ ਚਲਾਣ ਹੋ ਜਾਂਦਾ ਹੈ ਇਹ ਅਤੇ ਦੂਸਰਾ ਜਿਹੜਾ ਰੂਲ ਉਹਨੂੰ ਪਤਾ ਹੋਣਾ ਚਾਹੀਦਾ ਹੈ ਉਹ ਹੋਣਾ ਚਾਹੀਦਾ ਹੈ ਟਰੈਫਿਕ ਰੂਲਸ ਕਿਉਂਕਿ ਰੋਡ ਦੇ ਉੱਪਰ ਜਾ ਰਹੇ ਹਾਂ ਤਾਂ ਆਪਾਂ ਬਿਨਾਂ ਟਰੈਫਿਕ ਰੂਲਸ ਨੂੰ ਜਾਣਦੇ ਹੋਏ ਗੱਡੀ ਆਪਣੀ ਬਾਈਕ ਨਹੀਂ ਚਲਾ ਸਕਦੇ ਬਿਲਕੁਲ ਵੀ ਜਿਹੜੇ ਉਹਦੇ ਕੋਲ ਦਸਤਾਵੇਜ਼ ਹੋਣੇ ਜ਼ਰੂਰੀ ਹਨ ਉਹ ਹਨ ਉਹ ਹੈਗੇ ਹਨ ਲਾਈਸੈਂਸ ਪਹਿਲੇ ਨੰਬਰ 'ਤੇ ਤਾਂ ਲਾਈਸੈਂਸ ਹੋ ਗਿਆ ਦੂਸਰੇ ਨੰਬਰ 'ਤੇ ਆਪਣੇ ਕੋਲ ਆ ਰਿਹਾ ਜਿਹੜਾ ਆਪਾਂ ਬਾਈਕ ਚਲਾ ਰਹੇ ਹਾਂ ਉਹਦੀ ਪਲਿਊਸ਼ਨ ਤੀਸਰਾ ਸਾਡੇ ਨੰਬਰ 'ਤੇ ਆ ਰਿਹਾ ਹੈ ਉਹ ਹੈਗਾ ਹੈ ਸਾਡੀ ਆਰ ਸੀ ਜਿਹੜਾ ਆਪਾਂ ਬਾਈਕ ਚਲਾ ਰਹੇ ਹਾਂ ਉਹਦੀ ਆਰ ਸੀ ਹੋਣੀ ਤਾਂ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਬਾਕੀ ਪਤਾ ਰਹੇ ਪੇ ਉਹ ਕਿਸ ਦੀ ਬਾਈਕ ਹੈ ਅਤੇ ਕਿਸਦੇ ਨਾਮ ਦੇ ਉੱਪਰ ਹੈ ਇਹ ਸਾਰੀਆਂ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀਆਂ ਹਨ ਹਮੇਸ਼ਾ ਨਾਲ ਹੀ ਰਹਿਣੀਆਂ ਚਾਹੀਦੀਆਂ ਹਨ